ਇੱਕ ਕਲਾਕਾਰ ਲਈ ਇਹ ਮਹੱਤਵਪੂਰਨ ਹੁੰਦਾ ਹੈ ਕਿ ਉਹ ਆਪਣੇ ਕਲਾਕੋਸ਼ ਨੂੰ ਆਰਥਿਕ ਤੌਰ 'ਤੇ ਸਮਰਥ ਬਣਾਵੇ ਅਤੇ ਨਾਲ ਨਾਲ ਆਪਣੀ ਰਚਨਾਤਮਾ ਨੂੰ ਵੀ ਬਣਾਈ ਰੱਖੇ ਇਸ ਸੰਤੁਲਨ ਲਈ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਲਾਕਾਰ ਆਪਣੀ ਰਚਨਾਤਮਕਾਂ ਦੀ ਸਮਝੌਤਾ ਕਿਤੇ ਬਿਨ੍ਹਾਂ ਆਪਣੇ ਕੰਮ ਨੂੰ ਵਪਾਰਕ ਰਪਕ ਦੇ ਲਾਇਕ ਬਣਾ ਸਕਦੇ ਹਨ ਉਹ ਆਪਣੇ ਕੰਮ ਨੂੰ ਆਨਲਾਈਨ ਅਤੇ ਔਫਲਾਈਨ ਮਾਰਕੀਟ ਕਰਕੇ ਵੱਧ ਤੋਂ ਵੱਧ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕਦਾ ਹੈ ਇਸ ਦੇ ਨਾਲ ਹੀ ਕਈ ਵਾਰ ਕਲਾਕਾਰ ਆਪਣੇ ਸ਼ੌਂਕ ਅਤੇ ਵਕਾਰ ਵਪਾਰ ਵਿਚਕਾਰ ਸਮਾਂ ਵੰਡ ਕੇ ਕੰਮ ਕਰਦੇ ਹਨ ਉਹ ਆਪਣੀ ਅਸਲ ਰਚਨਾਤਮਕ ਨਾਲ ਵੱਖਰਾ ਸਮਾਂ ਰੱਖਦੇ ਹਨ ਜਦ ਕਿ ਵਪਾਰਕ ਉਦੇਸ਼ਾਂ ਲਈ ਉਹ ਆਮ ਮੰਗ ਅਨੁਸਾਰ ਕੰਮ ਕਰਦੇ ਹਨ ਇਸ ਤਰੀਕੇ ਨਾਲ ਇੱਕ ਕਲਾਕਾਰ ਆਪਣੀ ਅਜ਼ਾਦੀ ਨੂੰ ਕਾਇਮ ਵੀ ਰੱਖਦਾ ਹੈ ਅਤੇ ਵਪਾਰਕ ਤੌਰ 'ਤੇ ਆਪਣੇ ਆਪ ਨੂੰ ਉਹ ਸੰਤੁਲਿਤ ਵੀ ਬਣਾ ਸਕਦਾ ਹੈ ਉਹ ਆਪਣੇ ਕੰਮ ਨੂੰ ਆਨਲਾਈਨ ਅਤੇ ਆਫਲਾਈਨ ਮਾਰਕੀਟ ਕਰਕੇ ਵਧੇਰੇ ਲੋਕਾਂ ਤੱਕ ਪਹੁੰਚਾ ਸਕਦਾ ਹੈ ਇਸ ਦੇ ਨਾਲ ਉਹ ਆਪਣੀ ਨਵੀਂ ਤਕਨੀਕਾਂ ਅਤੇ ਵਧੀ ਵਧੀਕ ਸਰੋਤਰਾਂ ਨੂੰ ਆਪਣੀ ਕਲਾ ਨੂੰ ਉੱਚੀਆਂ ਉਚਾਈਆਂ 'ਤੇ ਲੈ ਸਕਦਾ ਹੈ ਹੋਰ ਰਚਨਾਤਮਕ ਅਤੇ ਵਪਾਰਕ ਵਕਤ ਵਿੱਚ ਵੀ ਸੰਤੁਲਨ ਬਨਾਏ ਰੱਖਦਾ ਹੈ ਉਹ ਆਪਣੀ ਇਸ ਕਲਾ ਕਲਾਕਾਰ ਵੀ ਨਾਲ ਵਪਾਰਕ ਪਰਤ ਅਤੇ ਰਚਨਾਤਮਕ ਪ੍ਰਕਿਰਿਆਂ ਵਿੱਚ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਲਾਕਾਰ ਸਿਰਫ਼ ਸ਼ੌਂਕ ਨਹੀਂ ਬਲਕਿ ਜੀਵਨ ਵਿਆਪਣ ਦਾ ਸਾਧਨ ਵੀ ਹੋ ਸਕਦਾ ਹੈ ਕਲਾਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਲਾ ਨੂੰ ਵਪਾਰਕ ਤਰੀਕੇ ਨਾਲ ਪੇਸ਼ ਕਰੇ ਜਿਸ ਨਾਲ ਉਹ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਮਜ਼ਬੂਤ ਹੋ ਸਕੇ